ਹੈਲੋ ਹਾਂਜੀ ਜੀ ਮੈਂ ਹੁਣੇ ਫਸਟ ਈਅਰ ਐਡਮਿਸ਼ਨ ਲਈ ਐ ਉਹਨੇ ਤਾਂ ਮੈਂ ਬਸ ਤੁਹਾਨੂੰ ਮੈਂ ਪੁੱਛਦਾ ਸੀ ਕਿ ਮੈਂ ਹਿਮਾਚਲ ਤੋਂ ਆ ਹਾਂਜੀ ਹਾਂਜੀ ਅਤੇ ਮੈਂ ਫਾੜ ਕਾਲਜ ਐਡਮਿਸ਼ਨ ਵੀ ਹੈ ਫਸਟ ਐਡਮਿਸ਼ਨ ਲਿਆ ਹਨ ਤੁਸੀਂ ਮੈਨੂੰ ਦੱਸੋਗੇ ਕਿ ਉਥੋਂ ਦਾ ਕੀ ਮਾਹੌਲ ਹੈ ਕਿ ਹਾਂਜੀ ਮੌਸਮ ਦਾ ਕੀ ਮਾਹੌਲ ਐ ਜਾ ਕਾਲਜ ਦਾ ਕਿੱਦਾਂ ਦਾ ਮਾਹੌਲ ਐ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਡੇ ਹਿਮਾਚਲ ਤਾਂ ਠੰਡ ਦਾ ਅਕਤੂਬਰ ਬਹੁਤ ਠੰਡ ਦਾ ਮਾਹੌਲ ਹੋ ਗਿਆ ਬਸ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਉਥੋਂ ਦਾ ਕੀ ਮਾਹੌਲ ਹੈ ਉਥੋਂ ਗਰਮੀ ਐ ਜਾਂ ਕਿ ਮੌਸਮ ਦਾ ਕੀ ਪ੍ਰਭਾਵ ਰਹਿੰਦਾ ਠੀਕ ਐ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਜਿਦਾਂ ਅੱਜ ਕੱਲ ਅੱਜ ਕੱਲ ਕਾਲਜ ਦੇ ਵਿੱਚ ਰੈਗਿੰਗ ਵਗੈਰਾ ਦਾ ਹੁੰਦਾ ਚੱਕਰ ਤਾਂ ਨਹੀਂ ਤੁਹਾਡੇ ਕਾਲਜ ਕਾਲਜ ਜਿਦਾਂ ਅੱਜਕੱਲ ਪੁਰਾਣੇ ਬੱਚੇ ਜਿਹੜੇ ਹੁੰਦੇ ਅੱਜ ਕੱਲ ਨਵੇਂ ਬੱਚਿਆਂ ਤੇ ਰੈਗਿੰਗ ਕਰਦੇ ਆ ਜਾ ਹਾਂਜੀ ਹਾਂਜੀ

ਹਾਂਜੀ ਠੀਕ ਐ ਜੀ ਹਾਂਜੀ ਹਾਂਜੀ ਹਾਂਜੀ ਠੀਕ ਐ ਜੀ ਠੀਕ ਐ ਦੀਦੀ ਮਤਲਬ ਠੀਕ ਐ ਜੀ ਸਾਡੇ ਹਿਮਾਚਲ ਤੈ ਹਿਮਾਚਲ ਦਾ ਠੰਡ ਪੈਣੀ ਸ਼ੁਰੂ ਹੋ ਗਈ ਬਹੁਤ ਠੰਡ ਪੈਣੀ ਸ਼ੁਰੂ ਹੋ ਗਈ ਅਕਤੂਬਰ ਕਰਕੇ ਤਾਂ ਬਸ ਮੈਂ ਆਰਿਆ ਸੀ ਫਸਟ ਈਅਰ ਕਾਲਜ ਐਡਮਿਸ਼ਨ ਲਈ ਐ ਤੇ ਕੋਈ ਮੈਮ ਥੈਂਕਯੂ ਦੱਸਣ ਵਾਸਤੇ ਤੁਹਾਡਾ ਬਹੁਤ ਬਹੁਤ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ

ਠੀਕ ਐ ਦੀਦੀ ਥੈਂਕਯੂ ਠੀਕ ਐ ਦੀਦੀ ਥੈਂਕਯੂ ਠੀਕ ਐ